ਭਾਰਤ ਭਿੰਨਤਾਵਾਂ ਭਰਿਆ ਦੇਸ਼ ਹੈ ਭਾਰਤ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਲੋਕ ਰਹਿੰਦੇ ਹਨ ਔਰ ਹਰ ਇੱਕ ਖਿੱਤੇ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਦੀ ਭਾਸ਼ਾ ਵੱਖਰੀ ਹੈ ਉਹਨਾਂ ਦਾ ਰਹਿਣ ਸਹਿਣ ਵੱਖਰਾ ਇਸੇ ਤਰ੍ਹਾਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਬੜਾ ਅੰਤਰ ਹੈ ਇਹ ਅੰਤਰ ਸੱਭਿਆਚਾਰਕ ਤੌਰ 'ਤੇ ਵੀ ਹੈ ਔਰ ਸਮਾਜਿਕ ਤੌਰ 'ਤੇ ਵੀ ਹੈ ਇਹਨਾਂ ਦੋਨਾਂ ਖੇਤਰਾਂ ਦੇ ਵਿੱਚ ਜਿਹੜੀ ਭਾਸ਼ਾ ਹੈ ਉਹ ਵੱਖਰੀ ਵੱਖਰੀ ਹੈ ਉੱਤਰੀ ਭਾਸ਼ਾ ਦੇ ਲੋਕਾਂ ਦੀ ਭਾਸ਼ਾ ਵੱਖਰੀ ਹੈ 'ਤੇ ਦੱਖਣੀ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਦੀ ਭਾਸ਼ਾ ਵੱਖਰੀ ਹੈ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੀ ਭਾਸ਼ਾ ਦਾ ਬੜਾ ਅੰਤਰ ਹੈ ਜੇਕਰ ਭੋਜਨ ਦੀ ਗੱਲ ਕਰੀਏ ਤਾਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਭੋਜਨ ਦੀ ਵਰਤੋਂ ਅਲੱਗ ਅਲੱਗ ਹੁੰਦੀ ਹੈ ਇਸੇ ਤਰ੍ਹਾਂ ਪਹਿਰਾਵਾ ਹੈ ਦੋਨੇ ਖਿੱਤਿਆਂ ਦੇ ਲੋਕਾਂ ਦਾ ਪਹਿਰਾਵਾ ਵੱਖੋ ਵੱਖਰਾ ਔਰ ਦੋਨਾਂ ਦੇ ਵਿੱਚ ਬੜਾ ਫਰਕ ਹੈ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਵਿੱਚ ਮੌਸਮ ਦਾ ਬਹੁਤ ਅੰਤਰ ਹੈ ਜੇਕਰ ਉੱਤਰੀ ਭਾਰਤ ਵਿੱਚ ਬਰਸਾਤ ਦਾ ਮੌਸਮ ਹੈ ਤਾਂ ਦੱਖਣੀ ਭਾਰਤ ਦੇ ਵਿੱਚ ਉਸ ਸਮੇਂ ਬੜੀ ਬੜੀ ਗਰਮੀ ਹੁੰਦੀ ਹੈ ਜਿਹੜੀ ਰਾਜਨੀਤੀ ਹੈ ਉਹ ਵੀ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੀ ਬੜੀ ਬਖਰੇਵੇਂ ਵਾਲੀ ਹੈ ਬੜਾ ਫਰਕ ਹੈ ਦੋਨਾਂ ਦੀ ਰਾਜਨੀਤੀ ਵਿੱਚ ਔਰ ਇਸੇ ਤਰ੍ਹਾਂ ਸ਼ਾਖਰਤਾ ਹੈ ਸ਼ਾਖਰਤਾ ਦਾ ਵੀ ਬੜਾ ਫਰਕ ਹੈ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਵਿੱਚ ਜਿਹੜਾ ਭੁਗੌਲ ਹੈ ਇਹ ਵੀ ਦੋਨੇ ਖੇਤਰਾਂ ਦਾ ਬੜਾ ਅਲੱਗ ਅਲੱਗ ਹੈ ਦੋਨਾਂ ਦੇ ਵਿੱਚ ਬੜਾ ਡਿਫਰੈਂਸ ਹੈ ਬੜਾ ਫਰਕ ਹੈ ਕੁੱਲ ਮਿਲਾ ਕੇ ਉੱਤਰੀ ਭਾਰਤ ਅਤੇ ਦੱਖਣੀ ਭਾਰਤ ਦੇ ਜਿਹੜੇ ਲੋਕ ਨੇ ਉਹਨਾਂ ਦੇ ਰਹਿਣ ਸਹਿਣ ਖਾਣ ਪੀਣ ਪਹਿਰਾਵਾ ਭਾਸ਼ਾ ਬੋਲੀ ਸੱਭਿਆਚਾਰ ਹਰ ਇੱਕ ਚੀਜ਼ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ